ਸਤਿ ਸ਼੍ਰੀ ਅਕਾਲ ਤੁਸੀਂ ਗੁਰਪ੍ਰੀਤ ਡਰਾਈਵਰ ਬੋਲ ਰਹੇ ਓਂ ਮੈਨੂੰ ਤੁਹਾਡਾ ਨੰਬਰ ਮੇਰੀ ਸਹੇਲੀ ਨੇ ਦਿੱਤਾ ਸੀ ਮੈਂ ਆਪਣੇ ਪਰਿਵਾਰ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਉੱਤੇ ਜਾਣਾ ਸੀ ਮੇਰੇ ਨਾਲ਼ ਚਾਰ ਹੋਰ ਮੈਂਬਰ ਹਨ ਅਸੀਂ ਤੀਹ ਨੌਂ ਤੇਈ ਨੂੰ ਸਵੇਰੇ ਛੇ ਵਜੇ ਆਪਣੇ ਘਰ ਖਰੜ ਬੈਂਕ ਕਲੋਨੀ ਤੋਂ ਨਿਕਲਣਾ ਸੀ ਤੁਸੀਂ ਪਰਸੋਂ ਟਾਈਮ ਨਾਲ਼ ਸਾਡੇ ਘਰ ਪਹੁੰਚ ਜਾਇਓ ਮੈਂ ਆਪਣਾ ਨੰਬਰ ਤੁਹਾਨੂੰ ਵਟਸਐਪ ਕਰ ਦਿੰਦੀ ਹਾਂ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਤੁਸੀਂ ਮੈਨੂੰ ਇਸ ਨੰਬਰ ਉੱਤੇ ਸੰਪਰਕ ਕਰ ਲਿਓ